ਸਾਡੇ ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਸਹਾਇਤਾ ਕਰਨ ਵਾਲੇ ਫੰਡਿੰਗ ਸਰੋਤ ਸਰਕਾਰ ਹੈ ਅਲੱਗ ਅਲੱਗ ਏਜੰਸੀਆਂ ਨੇ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਮਤਲਬ ਕਦਮ ਚੁੱਕਿਆ ਜਾਂਦਾ ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਹੈ ਇਸ ਨੂੰ ਜਿੰਦਾ ਰੱਖਿਆ ਜਾ ਸਕੇ ਅੱਜ ਦੇ ਸਮੇਂ ਦੇ ਵਿੱਚ ਜੋ ਪੰਜਾਬੀ ਸੱਭਿਆਚਾਰ ਹੈ ਉਹ ਅਲੋਪ ਹੁੰਦਾ ਜਾ ਰਿਹਾ ਹੈ ਅਗਰ ਆਪਾਂ ਦੇਖੀਏ ਤਾਂ ਬਹੁਤ ਘੱਟ ਚਰਖੇ ਕੱਢੀਆਂ ਹੋਈਆਂ ਘਰ ਕੱਢੀਆਂ ਹੋਈਆਂ ਆਪਣੀਆਂ ਦਾਦੀਆਂ ਨਾਨੀਆਂ ਵੱਲੋਂ ਫੁਲਕਾਰੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਕਾਫੀ ਸਾਰੇ ਸੱਭਿਆਚਾਰਕ ਮੇਲੇ ਵੀ ਲਗਾਏ ਜਾਂਦੇ ਹਨ ਜਿੱਥੇ ਸਾਨੂੰ ਅਲੱਗ ਅਲੱਗ ਸੱਭਿਆਚਾਰਕ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ ਚਰਖੇ ਵਗੈਰਾ ਹੋਰ ਵੀ ਬਹੁਤ ਜ਼ਿਆਦਾ ਸਾਡਾ ਪੁਰਾਣਾ ਸੱਭਿਆਚਾਰਿਕ ਜੋ ਪਹਿਰਾਵਾ ਸੀ ਉਹ ਦਿਖਾਇਆ ਜਾਂਦਾ ਹੈ ਏਜੰਸਿਸ ਦੇ ਵੱਲੋਂ ਕਾਫੀ ਕੁਝ ਫੰਡਿੰਗ ਕੀਤੀ ਜਾਂਦੀ ਆ ਮਦਦ ਕੀਤੀ ਜਾਂਦੀ ਹੈ ਤਾਂ ਜੋ ਸੱਭਿਆਚਾਰ ਹੈ ਇਸ ਨੂੰ ਸਾਡੇ ਦਿਲਾਂ ਦੇ ਵਿੱਚ ਜਿਉਂਦਾ ਰੱਖਿਆ ਜਾ ਸਕੇ